ਪਰਿਵਾਰ ਦੇ ਵਿੱਚ ਔਰ ਔਰਤ ਅਤੇ ਆਦਮੀ ਦੇ ਆਪੋ ਆਪਣੇ ਕੰਮ ਆ ਜਿਹੜੇ ਸਾਡੇ ਇੱਧਰ ਪੰਜਾਬ ਦੇ ਵਿੱਚ ਪਰਿਵਾਰ ਦੇ ਵਿੱਚ ਜਿਹੜੀ ਔਰਤ ਦਾ ਜਿਹੜਾ ਮੁੱਖ ਕੰਮ ਆ ਵੀ ਘਰ ਦੇ ਵਿੱਚ ਰੋਟੀ ਪਾਣੀ ਦੀ ਤਿਆਰੀ ਕਰਨੀ ਬੱਚਿਆਂ ਨੂੰ ਤਿਆਰ ਕਰਕੇ ਸਕੂਲ ਭੇਜਣਾ ਘਰ ਦਾ ਸਾਫ ਸਫਾਈ ਦਾ ਕੰਮ ਜਿਹੜਾ ਕਿ ਔਰਤ ਦਾ ਔਰਤ ਦਾ ਮੰਨਿਆ ਜਾਂਦਾ ਅਤੇ ਮਰਦ ਦਾ ਕੰਮ ਜਿਹੜਾ ਹੈ ਘਰ ਤੋਂ ਬਾਹਰ ਦੇ ਕੰਮ ਆ ਉਹ ਮਰਦ ਨੇ ਆਮ ਆਮ ਤੌਰ 'ਤੇ ਮੰਨੇ ਜਾਂਦੇ ਨੇ ਕਿ ਕੰਮ ਕਾਰ ਕਰਕੇ ਜੋ ਪੈਸੇ ਆਲੇ ਕੰਮ ਆ ਉਹ ਮਰਦ ਦੇ ਕਰਨੇ ਹੁੰਦੇ ਆ ਬਾਹਰ ਦਾ ਕੰਮ ਜੋ ਵੀ ਸਮਾਨ ਖਰੀਦ ਕੇ ਲਿਆਉਣਾ ਜਾਂ ਬਾਜ਼ਾਰੋਂ ਬਾਜ਼ਾਰ ਦੇ ਕੰਮ ਉਹ ਮਰਦ ਨੇ ਕਰਨੇ ਹੁੰਦੇ ਆ ਇਸ ਤਰ੍ਹਾਂ ਇਹਨਾਂ ਨੇ ਆਪੋ ਆਪਣੇ ਜਿਹੜੇ ਕੰਮ ਆ ਉਹ ਵੰਡੇ ਆ